ਮੇਰਾ ਪਸੰਦੀਦਾ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਰਚਿਆ ਹੋਇਆ ਗੀਤ ਹੈ ਜਿਹਦਾ ਨਾਮ ਹੈ ਇੱਕ ਕੁੜੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਉਹ ਗੁੰਮ ਹੈ ਗੁੰਮ ਹੈ ਗੁੰਮ ਹੈ ਇਹ ਪੰਜਾਬ ਵਿੱਚ ਬਹੁਤ ਹੀ ਸੁਣਿਆ ਜਾਣ ਵਾਲਾ ਗੀਤ ਹੈ ਇਹ ਗੀਤ ਮੈਂ ਗਾਉਣਾ ਵੀ ਪਸੰਦ ਕਰਦੀ ਹਾਂ ਅਤੇ ਸੁਣਨਾ ਵੀ ਪਸੰਦ ਕਰਦੀ ਹਾਂ ਇਹ ਗੀਤ ਨੂੰ ਕਈ ਫਿਲਮਾਂ ਵਿੱਚ ਵੀ ਫਿਲਮਾਇਆ ਗਿਆ ਹੈ ਭਾਵੇਂ ਉਹ ਪੰਜਾਬੀ ਦੀਆਂ ਫਿਲਮਾਂ ਨੇ ਅਤੇ ਭਾਵੇਂ ਉਹ ਹਿੰਦੀ ਦੀਆਂ ਫਿਲਮਾਂ ਸ਼ਿਵ ਕੁਮਾਰ ਬਟਾਲਵੀ ਸਾਡੇ ਪੰਜਾਬੀ ਦੇ ਉਹ ਜਿਹੇ ਗੀਤਕਾਰ ਹੋਏ ਨੇ ਜਿਨ੍ਹਾਂ ਨੇ ਬਿਰਹਾ ਦੇ ਗੀਤ ਬਹੁਤ ਲਿਖੇ ਨੇ ਪਰ ਉਹਦੇ ਵਿੱਚ ਰੂਹਾਨੀਅਤ ਅਤੇ ਮੁਹੱਬਤ ਦੇ ਗੀਤ ਉਹਨਾਂ ਦੇ ਬਹੁਤ ਘੱਟ ਨੇ ਜਿਹੜੇ ਕਿ ਬਹੁਤ ਹੀ ਪਸੰਦ ਕੀਤੇ ਜਾਣ ਵਾਲੇ ਨੇ ਉਹਨਾਂ ਵਿੱਚੋਂ ਇਹ ਗੀਤ ਪਹਿਲੇ ਨੰਬਰ 'ਤੇ ਆਉਂਦਾ ਹੈ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਉਹ ਗੁੰਮ ਹੈ ਗੁੰਮ ਹੈ ਗੁੰਮ ਹੈ